ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਰਸ਼ਨ ਕੌਰ ਹੈ ਤੁ ਤੁਸੀਂ ਗੋਪਾਲ ਸਵੀਟਸ ਤੋਂ ਗੱਲ ਕਰਦੇ ਹੋ ਮੈਂ ਤੁਹਾਡੇ ਤੋਂ ਸਮੋਸੇ ਮੰਗਵਾਏ ਸੀਗੇ ਉਹ ਖਰਾਬ ਨਿਕਲੇ ਆਲੂਆਂ 'ਚੋਂ ਸਮੈੱਲ ਆ ਰਹੀ ਹੈ ਜਦੋਂ ਮੈਂ ਸੋਸ ਖੋਲ੍ਹ ਕੇ ਦੇਖੀ ਸੋਸ ਵੀ ਖਰਾਬ ਪਈ ਹੈ ਅੱਗੇ ਕਦੇ ਇਹ ਜਿਹਾ ਅਹਿਸਾਸ ਹੋਇਆ ਨਹੀਂ ਤਾ ਇਹ ਪਹਿਲੀ ਵਾਰ ਹੋਇਆ ਅੱਗੇ ਤੁਹਾਡੇ ਤੋਂ ਸਮੋਸੇ ਮੰਗਾਉਂਦੇ ਹਾਂ ਦੇਖੋ ਜੀ ਜਾਂ ਤਾਂ ਤੁਸੀਂ ਮੇਰੇ ਸਮੋਸੇ ਵਾਪਸ ਕਰ ਲਉ ਜਾਂ ਤੁਸੀਂ ਮੈਨੂੰ ਨਵੇਂ ਭੇਜ ਦਿਉ ਨਹੀਂ ਤੁਸੀਂ ਮੇਰੇ ਪੈਸੇ ਮੈਨੂੰ ਦੇ ਸਕਦੇ ਹੋ ਜੇ ਤੁਸੀਂ ਪੈਸ ਸਮੋਸੇ ਨਹੀਂ ਵਾਪਸ ਕਰਦੇ ਤੁਸੀਂ ਮੇਰੇ ਪੈਸੇ ਦੇ ਦਿਉ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੀ